ਸਾਡੇ ਖੇਤਰ 'ਚ ਜੀ ਦਸਵੀਂ ਤੋਂ ਬਾਅਦ ਬੱਚੇ ਪਲਸ ਟੂ ਕਰਦੇ ਆਰਟਸ ਹੈ ਕਮਰਸ ਹੈ ਨੋਨ ਮੈਡੀਕਲ ਮੈਡੀਕਲ ਇਹ ਨੇ ਜੀ ਇਹ ਸਾਰੀਆਂ ਤਰਜੀਹਾਂ ਇਹਨਾਂ ਨੂੰ ਮਿਲਦੀਆਂ ਨੇ ਹੋਰ ਨੇੜੇ ਬਸ ਇਹ ਹੈ ਕਿ ਸਾਡੇ ਨੇੜੇ ਦੇ ਏਰੀਏ ਦੇ ਵਿੱਚ ਇੱਕ ਜਿਵੇਂ ਸਕੂਲ ਉਹਦੇ ਵਿੱਚ ਸਿਰਫ ਆਰਟਸ ਹੀ ਹੈ ਹੋਰ ਕੋਈ ਉਹ ਨਹੀਂ ਹੈ ਸਟਰੀਮ ਹੈ ਹੀ ਨਹੀਂ ਆ